ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਪਿੰਕੀ ਬੋਲਦੀ ਪਈ ਹਾਂ ਸਲਾਮਾਬਾਦ ਮੁਹੱਲੇ ਤੋਂ ਅਤੇ ਅਸੀਂ ਇੱਕ ਕੁੱਤਾ ਰੱਖਿਆ ਦਾ ਹੈਗਾ ਘਰ ਮਤਲਬ ਕਿ ਬਹੁਤ ਸਾਨੂੰ ਸਾਡਾ ਉਹਦੇ ਨਾਲ ਪਿਆਰ ਹੈ ਅਤੇ ਅਸੀਂ ਉਹਨੂੰ ਆਪਣੇ ਬੱਚਿਆਂ ਵਾਂਗ ਰੱਖੀਦਾ ਉਹਨੂੰ ਖਾਣਾ ਵਗੈਰਾ ਮਤਲਬ ਕਿ ਹਰ ਇੱਕ ਚੀਜ਼ ਟਾਈਮ ਨਾਲ ਦਿੰਦੇ ਆ ਮਤਲਬ ਕਿ ਬਹੁਤ ਸਾਫ ਸੁਥਰਾ ਅਸੀਂ ਉਹਨੂੰ ਬਹੁਤ ਪਿਆਰ ਕਰਦੇ ਹਾਂ ਅਸੀਂ ਨਵਾਨੇ ਵੀ ਸੁਆਨੇ ਵੀ ਮਤਲਬ ਕਿ ਆਪਣੇ ਨਾਲ ਬੈਡ ਦੇ ਉੱਤੇ ਹੀ ਹਾਂ ਅਤੇ ਉਹ ਬਹੁਤ ਹੀ ਮਤਲਬ ਕਿ ਚੰਗਾ ਆ ਕੁੱਤਾ ਅਤੇ ਉਹਦਾ ਨਾਮ ਬਰੂਨੋ ਆ ਰੱਖੇ ਦਾ ਅਸੀਂ ਅਤੇ ਮਤਲਬ ਕਿ ਬਹੁਤ ਚੰਗਾ ਆ ਵੋ ਉਹ ਅਸੀਂ ਬੱਚਿਆਂ ਨਾਲੋਂ ਵੀ ਬੱਚਿਆਂ ਵਾਂਗਰ ਹੀ ਉਹਨੂੰ ਪਿਆਰ ਕਰਦੇ ਹਾਂ ਰੋਟੀ ਵਗੈਰਾ ਖਾਣਾ ਟਾਈਮ ਸਿਰ ਦਿੰਦੇ ਹਾਂ ਉਹਨੂੰ ਦੁੱਧ ਨਾਲ ਰੋਟੀ ਵਗੈਰਾ ਸਾਰਾ ਕੁਝ ਦਿੰਦੇ ਹਾਂ ਉਹਨੂੰ ਜੋ ਵੀ ਨੋਨ ਵੈਜ ਜੋ ਵੀ ਹੁੰਦਾ ਕੁੱਤੇ ਦੀ ਖੁਰਾਕ ਉਹ ਅਸੀਂ ਟਾਈਮ ਸਿ ਟਾਈਮ ਨਾਲ ਦਿੰਦੇ ਆ ਉਹਨਾਂ ਨੂੰ ਸਾਰਾ ਕੁਝ ਅਸੀਂ ਬੱਚਿਆਂ ਵਾਂਗ ਰੱਖੀਦਾ ਉਹ ਵੀ ਸਾਡੇ ਨਾਲ ਬਹੁਤ ਮਤਲਬ ਕਿ ਪਿਆਰ ਕਰਦਾ ਸੀ ਇਹਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਸਾਡੇ ਨਾਲ ਹੀ ਸੋਂਦਾ ਆ ਅਤੇ ਮਤਲਬ ਕਿ ਅਸੀਂ ਉਹਦਾ ਬਹੁਤ ਅੱਛੀ ਤਰ੍ਹਾਂ ਧਿਆਨ ਰੱਖਦੇ ਹਾਂ ਕੁੱਤੇ ਦਾ ਮਤਲਬ ਕਿ ਬਹੁਤ ਸਾਫ ਸੁਥਰਾ ਅਸੀਂ ਉਹਦੀ ਸਾਫ ਸ ਸਾਫ ਸਫਾਈ ਵੀ ਡੇਲੀ ਰੋਜ਼ ਨਵਾਂਦੇ ਧਵਾਂਦੇ ਹਾਂ ਕੁੱਤੇ ਨੂੰ ਅਤੇ ਮਤਲਬ ਕਿ ਬਹੁਤ ਚੰਗਾ ਹੈ ਸਾਡੇ ਨਾਲ ਸਾਡਾ ਬਹੁਤ ਪਿਆਰ ਹੈਗਾ ਕੁੱਤੇ ਨਾਲ